ਕਿਸਾਨਾਂ ਨੂੰ ਇਹ ਯਕੀਨੀ ਬਣਾਉਂਦੇ ਹਨ ਕਿ ਜਿਵੇਂ ਪਸ਼ੂਆਂ ਨੂੰ ਜੋ ਜਿਹੜੀ ਜਗਾਵਾਂ ਜੋ ਸਹੂਲਤਾਂ ਹੈ ਕੋਈ ਵੀ ਸਹੂਲਤ ਹੋ ਗਈ ਜਿਵੇਂ ਕਿ ਹਵਾਦਾਰ ਕਮਰੇ ਹੋ ਗਏ ਹਵਾਦਾਰ ਕਮਰਿਆਂ ਤੋਂ ਇਲਾਵਾ ਜਿਵੇਂ ਜਗ੍ਹਾਂ ਖੁੱਲੀ ਜਗ੍ਹਾ ਜਿਹਨੂੰ ਕਹਿੰਦੇ ਆ ਖੁੱਲੀ ਜਗ੍ਹਾ ਚਾਹੀਦੀ ਹੈ ਜਿੱਥੇ ਅਸੀਂ ਆਪਣੇ ਪਸ਼ੂ ਰੱਖ ਸਕਦੇ ਹਾਂ ਜੋ ਕਿਸਾਨ ਹੈ ਆਪਣੇ ਪਸ਼ੂਆਂ ਨੂੰ ਬਹੁਤ ਅੱਛੇ ਤਰੀਕੇ ਨਾਲ ਵਧੀਆ ਤਰੀਕੇ ਦੇ ਨਾਲ ਪਾਲ ਸਕਦੇ ਹੈ ਜੇ ਉਹਨਾਂ ਕੋਲ ਬਹੁਤ ਲੋੜੀਂਦੀ ਜਗ੍ਹਾ ਹੋਏਗੀ ਮਤਲਬ ਖੁੱਲ੍ਹੀ ਵੀ ਜਗ੍ਹਾ ਹੋਣੀ ਚਾਹੀਦੀ ਹੈ ਉਹ ਅਤੇ ਜਿਹਦੇ ਵਿੱਚ ਹਵਾ ਵੀ ਪਾ ਹਵਾ ਲੰ ਲੰਘਦੀ ਹੋਣੀ ਚਾਹੀਦੀ ਹੈ ਠੀਕ ਹੈ ਠ 'ਚ ਠੰਡੀ ਹਵਾ ਹੋਣੀ ਚਾਹੀਦੀ ਹੈ ਗਰਮੀਆਂ ਦੇ ਵਿੱਚ ਅਤੇ ਜਿਸ ਦੇ ਨਾਲ ਕੀ ਹੋਏਗਾ ਕਿ ਪਸ਼ੂ ਜੋ ਹੈ ਪਸ਼ੂਆਂ ਨੂੰ ਇੱਕ ਤਾਂ ਖੁੱਲ੍ਹੀ ਜਗ੍ਹਾ ਮਿਲ ਜਾਏਗੀ ਤੁਰਨ ਦੇ ਲਈ ਠੀਕ ਹੈ ਜਿਵੇਂ ਗਊਸ਼ਾਲਾ ਹੋਵੇ 'ਚ ਵੀ ਪਸ਼ੂਆਂ ਨੂੰ ਜੋ ਰੱਖਦੇ ਹੈ ਉਹਨਾਂ ਨੂੰ ਤਾਂ ਇੱਕ ਬੰਦ ਮਤਲਬ ਕਹਿ ਲਓ ਥੋੜ੍ਹੀ ਕੰਧਾਂ ਕਰਕੇ ਰੱਖਦੇ ਹੈ ਹੈ ਨਾ ਅਤੇ ਖੁੱਲ੍ਹੀ ਜਗ੍ਹਾ ਉਹਨਾਂ ਨੂੰ ਘੱਟ ਮਿਲਦੀ ਹੈ ਪਰ ਆਪਾਂ ਨੂੰ ਇਹ ਚਾਹੀਦਾ ਕਿ ਇਹ ਕਿਸਾਨਾਂ ਨੂੰ ਵੀ ਇਹ ਇਹੋ ਜਿਹੇ ਮਤਲਬ ਸਹੂਲਤਾਂ ਦੇਣੀਆਂ ਚਾਹੀਦੀਆਂ ਜਿਵੇਂ ਕਿ ਉਹਨਾਂ ਨੂੰ ਜਗ੍ਹਾ ਦੇ ਦਿੱਤੀ ਆਪਣੇ ਤੁਸੀਂ ਪਸ਼ੂ ਰੱਖ ਸਕਦੇ ਓਂ ਤਾਂ ਕਿ ਜਿਹੜੇ ਪਸ਼ੂ ਹੈ ਉਹ ਵੀ ਤਨਾਅ ਘੱਟ ਤਨਾਅ ਮੁਕਤ ਰਹਿਣਗੇ ਆਪਣਾ ਵਧੀਆ ਤੁਰਨ ਫਿਰਨਗੇ ਉਹਨਾਂ ਨੂੰ ਠੰਡੀ ਹਵਾ ਮਿਲੇਗੀ ਗਰਮੀਆਂ ਦੇ ਵਿੱਚ ਠੀਕ ਹੈ ਅਤੇ ਜਿਸ ਨਾਲ ਉਹ ਆਪਣੇ ਜਦੋਂ ਕਿਸਾਨ ਆਪਣੇ ਪਸ਼ੂਆਂ ਨੂੰ ਪਾਲਦੇ ਪਾਲਣਗੇ ਅਤੇ ਉਹ ਉਹ ਉਹਨਾਂ ਨੂੰ ਜੋ ਉਹਨਾਂ ਤੋਂ ਆਪਣੇ ਮਤਲਬ ਜਿਵੇਂ ਦੁੱਧ ਮਿਲਦਾ ਉਹਦੇ ਤੋਂ ਹੈ ਨਾ ਜੋ ਪਸ਼ੂ ਕਿਸਾਨਾਂ ਨੂੰ ਉਹਨਾਂ ਤੋਂ ਦੁੱਧ ਮਿਲਦਾ ਹੈ ਠੀਕ ਹੈ ਉਹ ਵਧੀਆ ਤਰੀਕੇ ਨਾਲ ਅਗਰ ਪਾਲਣਗੇ ਜੇ ਉਹਨਾਂ ਨੂੰ ਸਹੂਲਤਾਂ ਪਰ ਦੇਣਗੇ ਠੀਕ ਹੈ ਸਹੂਲਤਾਂ ਪ੍ਰਦਾਨ ਕਰਨਗੇ ਫਿਰ ਹੀ ਉਹ ਜਿਹੜੇ ਹੈਗੇ ਆ ਪਸ਼ੂ ਘੱਟ ਬਿਮਾਰ ਹੋਣਗੇ ਵਧੀਆ ਉਹਨਾਂ ਨੂੰ ਚੀਜ਼ਾਂ ਜਿਵੇਂ ਵਧੀਆ ਦੁੱਧ ਪ੍ਰਦਾਨ ਕਰਨਗੇ ਠੀਕ ਹੈ ਅਗਰ ਉਹਨਾਂ ਨੂੰ ਉਹ ਜਗ੍ਹਾ ਨਹੀਂ ਮਿਲੇਗੀ ਘੱਟ ਜਗ੍ਹਾ ਹੋਏਗੀ ਜਾਂ ਜੇ ਜਿਹੜੇ ਕਮਰੇ ਹੋਣਗੇ ਹਵਾਦਾਰ ਨਹੀਂ ਹੋਣਗੇ ਕੁਝ ਇਥੋਂ ਹਵਾ ਨਹੀਂ ਲੰਘਦੀ ਹੋਏਗੀ ਅਗਰ ਉਹੋ ਜਿਹੇ ਕਮਰੇ ਵਿੱਚ ਉਹਨਾਂ ਨੂੰ ਰੱਖਿਆ ਜਾਵੇ ਤਾਂ ਪਸ਼ੂ ਬਹੁਤ ਬਿਮਾਰ ਵੀ ਹੋ ਸਕਦੇ ਹੈ ਜਿਸ ਦੇ ਕਰਕੇ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ ਉਹ ਤਨਾਅ ਦੇ ਵਿੱਚ ਵੀ ਜਾ ਸਕਦੇ ਹੈ ਅਤੇ ਫਿਰ ਉਹਨਾਂ ਤੋਂ ਜੋ ਵੀ ਸਹੂਲਤਾਂ ਮਿਲਦੀਆਂ ਹਨ ਜਿਵੇਂ ਕਿ ਦੁੱਧ ਮਿਲਦਾ ਹੈ ਤਾਂ ਉਹ ਉਨੀ ਕਿਸਾਨਾਂ ਨੂੰ ਲਾਗਤ ਨਹੀਂ ਹੋਏਗੀ ਅਤੇ ਜੇ ਤਾਂ ਕਰਕੇ ਕਿਸਾਨਾਂ ਨੂੰ ਇਹ ਸੁਰੱਖਿਅਤ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਚਾਹੇ ਉਹ ਜਗ੍ਹਾ ਹੋਵੇ ਚਾਹੇ ਉਹ ਹਵਾਦਾਰ ਕਮਰੇ ਹੋਣ ਖੁੱਲ੍ਹੀ ਜਗ੍ਹਾ ਹੋਵੇ ਜਿੱਥੇ ਉਹ ਪਸ਼ੂਆਂ ਨੂੰ ਖੁੱਲ੍ਹੇ ਤਰੀਕੇ ਨਾਲ ਚਾਰਾ ਦੇ ਸਕਣ ਤਾਂ ਕਿ ਪਸ਼ੂ ਤਨਾਅ ਮੁਕਤ ਰਹਿਣ ਅਤੇ ਜੋ ਪ੍ਰਧਾਨ ਦੁੱਧ ਦੁੱਧ ਵਧੀਆ ਤਰੀਕੇ ਨਾਲ ਪ੍ਰਦਾਨ ਕਰਨ